ਹੈਲੋ ਮੈ ਮੀ ਮੀਸ਼ੋ ਤੋਂ ਇੱਕ ਬੈਡ ਸ਼ੀਟ ਖਰੀਦੀ ਜੋ ਮੈਨੂੰ ਟਾਈਮ ਤੋਂ ਪਹਿਲਾਂ ਹੀ ਮਿਲ ਗਈ ਇਸਦੀ ਪੈਕਿੰਗ ਬਹੁਤ ਹੀ ਵਧੀਆ ਹੈ ਜਦੋਂ ਮੈਂ ਇਸਨੂੰ ਖੋਲ੍ਹਿਆ ਤਾਂ ਉਹ ਪੈਕਿੰਗ 'ਤੇ ਉਹਦਾ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਸੀ ਜੋ ਮੈਨੂੰ ਉਹੀ ਮਿਲਿਆ ਜੋ ਮੈਂ ਔਡਰ ਕੀਤਾ ਸੀ ਇਸਦਾ ਕੱਪੜਾ ਪਿਓਰ ਕੋਟਨ ਕਿੰਗ ਸਾਈਜ਼ ਵਿੱਚ ਸੀ ਇਹਦੀ ਕੁਆਲਿਟੀ ਲੋਅ ਸੀ ਜਿਹਨ ਜਿਹਨੂੰ ਦੇਖ ਕੇ ਮੈਨੂੰ ਇੱਦਾਂ ਲੱਗਿਆ ਸੀ ਕਿ ਇਹ ਕੱਪੜਾ ਵਧੀਆ ਨਹੀਂ ਹੋਊਗਾ ਪਰ ਇਹ ਬਹੁਤ ਜ਼ਿਆਦਾ ਵਧੀਆ ਸੀ ਇਸਨੂੰ ਮੇਰੇ ਘਰਦਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਮੈਂ ਜਦੋਂ ਇਹਨੂੰ ਇੱਕ ਵਾਰੀ ਧੋਤਾ ਤਾਂ ਧੋਣ ਤੋਂ ਬਾਅਦ ਵੀ ਇਹ ਕੱਪੜਾ ਹੋਰ ਜ਼ਿਆਦਾ ਮੁਲਾਇਮ ਹੋ ਗਿਆ ਜਿਸਦੇ ਕਰਕੇ ਇਹਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਜਿਸਨੇ ਵੀ ਇਹਨੂੰ ਦੇਖਿਆ ਹੈ ਉਹਨੇ ਕਿਹਾ ਹੈ ਕਿ ਇਹ ਬਹੁਤ ਜ਼ਿਆਦਾ ਵਧੀਆ ਕੱਪੜਾ ਹੈ ਅਤੇ ਇਸਦੀ ਹੋਰ ਜ਼ਿਆਦਾ ਇਸ ਕੱਪੜੇ ਦੀ ਹੋਰਨਾਂ ਨੇ ਡਿਮਾਂਡ ਕੀਤੀ ਹੈ ਕਿ ਜੇ ਮੀਸ਼ੋ ਤੋਂ ਹੋਰ ਕੱਪੜਾ ਮਿਲਦਾ ਹੈ ਤਾਂ ਉਹ ਮੈਨੂੰ ਵੀ ਇਸ ਦੇ ਬਾਰੇ ਦੱਸਣ ਤਾਂ ਜੋ ਮੈਂ ਇਹਨੂੰ ਖਰੀਦ ਸਕਾਂ